ਯੋਗਾ ਮੈਂ ਰੋਜ਼ਾਨਾ ਸਵੇਰੇ ਉੱਠ ਕੇ ਨਹਾ ਧੋ ਕੇ ਪਾਰਕ ਵਿੱਚ ਜਾਂਦਾ ਹਾਂ ਅਤੇ ਉੱਥੇ ਜਾ ਕੇ ਯੋਗਾ ਕਰਦਾ ਹਾਂ ਮੈਂ ਆਪਣੀ ਉਮਰ ਦੇ ਹਿਸਾਬ ਨਾਲ ਯੋਗਾ ਵਿੱਚ ਤਬਦੀਲੀਆਂ ਕਰਦਾ ਹਾਂ ਜਿਵੇਂ ਕਿ ਛੋਟੇ ਹੁੰਦੇ ਮੈਂ ਵੱਖ ਵੱਖ ਤਰ੍ਹਾਂ ਦੇ ਆਸਣ ਸਿੱਖਦਾ ਸੀ ਅਤੇ ਰੋਜ਼ਾਨਾ ਕਰਦਾ ਸੀ ਅਤੇ ਅੱਜ ਦੇ ਸਮੇਂ ਵਿੱਚ ਬਜ਼ੁਰਗ ਬੰਦਿਆਂ ਨੂੰ ਅਨੁਲੋਮ ਵਿਲੋਮ ਕਰਨਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਸਰੀਰ ਵਿੱਚ ਫਰਤੂਲੀ ਬਣੀ ਰਹਿੰਦੀ ਹੈ ਜਿਸ ਕਰਕੇ ਉਹ ਕਾਫ਼ੀ ਬਿਮਾਰੀਆਂ ਤੋਂ ਉਹਨਾਂ ਦਾ ਸਰੀਰ ਬਚਿਆ ਰਹਿੰਦਾ ਹੈ ਯੋਗਾ ਕਰਨ ਨਾਲ ਸਾਨੂੰ ਸਾਡੇ ਸਰੀਰ ਵਿੱਚ ਫਰਤੂਲੀ ਦੀ ਮਹਿਸੂਸੀ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਯੋਗਾ ਸਵੇਰੇ ਉੱਠਕੇ ਰੋਜ਼ਾਨਾ ਕਰਨਾ ਚਾਹੀਦਾ ਹੈ ਧੰਨਵਾਦ